ਦੇਖਣ ਲਈ ਮੇਰੀਆਂ ਮਨਪਸੰਦ ਥਾਵਾਂ ਗੁਰਦੁਆਰਾ ਸਾਹਿਬ ਹਨ ਜਿਵੇਂ ਕਿ ਕਤਲਗੜ੍ਹ ਸਾਹਿਬ ਤਾੜੀ ਸਾਹਿਬ ਅਤੇ ਮੈਂ ਉਨ੍ਹਾਂ ਨੂੰ ਇਸ ਕਰਕੇ ਪਸੰਦ ਕਰਦੀ ਹਾਂ ਕਿਉਂਕਿ ਉੱਥੇ ਜਾ ਕੇ ਗੁਰਬਾਣੀ ਕੀਰਤਨ ਸੁਣ ਕੇ ਸੇਵਾ ਭਾਵ ਸੇਵਾ ਕਰਕੇ ਮੇਰੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਇਸ ਤੋਂ ਇਲਾਵਾ ਹੋਰ ਮਨਪਸੰਦ ਥਾਵਾਂ ਥੀਮ ਪਾਰਕ ਹਨ ਜੋ ਕਿ ਸਾਨੂੰ ਸਾਡੇ ਇਤਾਹਸ ਤੋਂ ਜਾਣੂੰ ਕਰਵਾਉਦੀਆਂ ਹਨ ਇਸ ਲਈ ਉਹ ਮੈਨੂੰ ਪਸੰਦ ਹਨ